ਹੈਲੋ ਹਾਂਜੀ ਹਾਂਜੀ ਹਾਂਜੀ ਹਾਂਜੀ ਇਹ ਇਕ ਰੁਪਈਆ ਏ ਦੋਨੋ ਨਹੀਂ ਦੋਨਾਂ ਤੋਂ ਦੋ ਰੁਪਏ ਹੋ ਜਾਣਗੇ ਇੱਕ ਸਾਈਡ ਤੇ ਇੱਕ ਰੁਪਇਆ ਏ ਹਾਂਜੀ ਹਾਂਜੀ ਚਲੋ ਆਪਾਂ ਡੇਢ ਕਰ ਲਾਂਗੇ ਦੋਨੋ ਸਾਈਡ ਦਾ ਹਾਂਜੀ ਹਾਂਜੀ ਹਾਂਜੀ ਬਾਇੰਡ ਵੀ ਕਰ ਦਾਂਗੇ ਹਾਂਜੀ ਹਾਂਜੀ ਉਹ ਫਿਫਟੀ ਰੁਪੀਜ਼ ਹਾਂਜੀ ਹਾਂਜੀ ਨਹੀਂ ਨਹੀਂ ਨਿਕਲਦੇ ਨੀ ਹੈਗੇ ਜਿਵੇਂ ਅੱਜ ਕੱਲ ਚੱਲਦੀ ਹੈ ਨਾ ਉਹ ਬਲਿਊ ਜੀ ਆਲੀ ਜਿਵੇਂ ਅੱਜ ਕੱਲ ਬੁੱਕਸ ਵਗੈਰਾ ਤੇ ਹੁੰਦੀ ਐ ਹਾਂਜੀ ਉਹੀ ਹੋਵੇਗੀ ਪੇਜ ਨੀ ਨਿਕਲਦੇ ਹਾਂਜੀ ਹਾਂਜੀ ਹਾਂਜੀ ਹਾਂਜੀ ਕੋਈ ਤੁਸੀਂ ਮਤਲਬ ਜਿਵੇਂ ਮੋਰਨਿੰਗ ਦੇ ਜਾਇਓ ਤੇ ਈਵਨਿੰਗ ਲੈ ਜਾਇਓ ਜੀ ਹਾਂਜੀ ਬਾਕੀ ਉਹ ਜਿਵੇਂ ਤੁਸੀਂ ਕਰਾਉਦੇ ਹੋ ਸੀਰੀਅਲ ਵਾਈਜ਼ ਲੱਗੀ ਹੋਣਗੇ ਬੁੱਕ ਹੀ ਕਰਾਉਣੀ ਹੋਏਗੀ ਹਾਂਜੀ ਬਸ ਸਹੀ ਏ ਫਿਰ ਉਨੀ ਅਸੀਂ ਫਿਰ ਕਰਕੇ ਸੀਰੀਅਲ ਵਾਈਜ਼ ਓਵੇਂ ਲਾ ਦੇਵਾਂਗੇ ਹਾਂਜੀ ਹਾਂਜੀ ਨਹੀਂ ਉਹ ਇੱਕ ਤਾਂ ਜਿਵੇਂ ਨੋਰਮਲ ਸਾਈਜ਼ ਆ ਜਾਂਦਾ ਨਾ ਜਿਵੇਂ ਅੱਖਰਾਂ ਦਾ ਉਹ ਤੁਸੀਂ ਇੱਕ ਦੋ ਪੇਜ ਤੁਹਾਨੂੰ ਕਰਕੇ ਦਿਖਾ ਦਾਂਗੇ ਵੀ ਆਪਾਂ ਸਾਈਜ਼ ਵੱਡਾ ਕਰਨਾ ਉਹਨਾਂ ਦਾ ਜਾਂ ਉਨਾ ਹੀ ਰੱਖਣਾ ਏ ਹਾਂਜੀ ਹਾਂਜੀ ਠੀਕ ਹੈ ਜੀ ਜਰੂਰ ਆਇਓ ਹਾਂਜੀ ਠੀਕ ਹੈ ਜੀ ਠੀਕ ਹੈ ਜੀ